ਹਾਂ ਮੈਂ ਫਿਲਮਾਂ ਅਤੇ ਟੀ ਵੀ ਸ਼ੋ ਦੇਖਣ ਦੇ ਲਈ ਨੈਟਫਲਿਕਸ ਅਤੇ ਪ੍ਰਾਈਮ ਵਰਗੀ ਸਟਰੀਮਿੰਗ ਸੇਵਾ ਦੀ ਵਰਤੋਂ ਕਰਦੀ ਹਾਂ ਮੈਂ ਅਕਸਰ ਇਹਨਾਂ ਦੀ ਵਰਤੋਂ ਫਿਲਮਾਂ ਜਾਂ ਵੈਬ ਸੀਰੀ ਜਾਂ ਆਪਣੇ ਫੇਵਰੇਟ ਟੀ ਵੀ ਸ਼ੋ ਦੇਖਣ ਲਈ ਇਹਨਾਂ ਨੂੰ ਵਰਤਦੀ ਹਾਂ ਜਦੋਂ ਮੇਰੇ ਕੋਲ ਟੀ ਵੀ ਦੇਖਣ ਦਾ ਸਮਾਂ ਨਹੀਂ ਹੁੰਦਾ ਤਾਂ ਮੈਂ ਜਿਹੜਾ ਮੇਰਾ ਐਪੀਸੋਡ ਟੀ ਵੀ 'ਤੇ ਮਿਸ ਹੋ ਜਾਂਦਾ ਹੈ ਤਾਂ ਮੈਂ ਉਹ ਆ ਕੇ ਆਪਣੇ ਫੋਨ 'ਤੇ ਦੇਖ ਲੈਂਦੀ ਹਾਂ ਜਦੋਂ ਮੈਂ ਇਹਨਾਂ ਨੂੰ ਫੋਨ 'ਤੇ ਦੇਖਦੀ ਹਾਂ ਤਾਂ ਮੈਨੂੰ ਬਹੁਤ ਹੀ ਪ੍ਰਾਈਵੇਸੀ ਮਿਲਦੀ ਹੈ ਮੈਨੂੰ ਕੁਛ ਵੀ ਦੇਖਣ ਲਈ ਮੈਨੂੰ ਇਹ ਹੁੰਦਾ ਹੈ ਕਿ ਮੈਂ ਇਕੱਲੀ ਹੀ ਦੇਖਾ ਕੋਈ ਵੀ ਮੈਨੂੰ ਡਿਸਟਰਬ ਨਾ ਕਰੇ ਫੋਨ 'ਤੇ ਦੇਖਣ ਨਾਲ ਅਸੀਂ ਖੁਦ ਦੇਖ ਸਕਦੇ ਹਾਂ ਅਗਰ ਸਾਡੇ ਕੋਲ ਕੋਈ ਬੈਠਾ ਹੋਇਆ ਹੈ ਅਗਰ ਉਹਨੇ ਨਹੀਂ ਦੇਖਣਾ ਤਾਂ ਅਸੀਂ ਖੁਦ ਆਪਣੇ ਫੋਨ 'ਤੇ ਏਅਰਫੋਰ ਲਗਾ ਕੇ ਉਹਨਾਂ ਨੂੰ ਦੇਖ ਸਕਦੇ ਹਾਂ ਫੋਨ 'ਤੇ ਟੀ ਵੀ ਨਾਲ ਇਹਦੀ ਤੁਲਨਾ ਮੈਂ ਕਰ ਸਕਦੀ ਹਾਂ ਕਿਉਂਕਿ ਟੀ ਵੀ ਦੇ ਵਿੱਚ ਅਸੀਂ ਇੱਕ ਵਾਰੀ ਜੋ ਸ਼ੋ ਲੰਘ ਗਿਆ ਉਹ ਲੰਘ ਗਿਆ ਅਸੀਂ ਉਹਨੂੰ ਦੁਬਾਰਾ ਨਹੀਂ ਦੇਖ ਸਕਦੇ ਮਗਰ ਫੋਨ ਦੇ ਵਿੱਚ ਅਸੀਂ ਦੁਬਾਰਾ ਦੁਬਾਰਾ ਦੇਖ ਸਕਦੇ ਹਾਂ ਅਤੇ ਇਹ ਜਿਹੜੀ ਸਟਰੀਮਿੰਗ ਦੀ ਸੇਵਾ ਹੈ ਇਹ ਬਹੁਤ ਘੱਟ ਰੁਪਏ ਵਿੱਚ ਹੈ ਅਤੇ ਕੇਬਲ ਦੇ ਅਸੀਂ ਪੈਸੇ ਬਹੁਤ ਜ਼ਿਆਦਾ ਮਹਿੰਗੀ ਹੈ ਬਹੁਤ ਜ਼ਿਆਦਾ ਪੈਸੇ ਉਹਦੇ ਭਰਦੇ ਹਾਂ ਮਗਰ ਇਹਨਾਂ ਦੀ ਅਸੀਂ ਘੱਟ ਪੈਸੇ ਦੇ ਵਿੱਚ ਵਧੀਆ ਕੁਆਲਿਟੀ ਦੇ ਵਿੱਚ ਸ਼ੋ ਅਤੇ ਫਿਲਮਾਂ ਦੇਖ ਸਕਦੇ ਹਾਂ